ਅਸੀਂ ਸਾਡੇ ਪੇਂਡੂ ਖੇਤਰ ਹੋਣ ਕਰਕੇ ਪਿੰਡਾਂ ਦੇ ਵਿੱਚ ਛੋਟੀਆਂ ਡਿਸਪੈਂਸਰੀਆਂ ਹੈ ਜਿੱਥੇ ਕਿ ਡਾਕਟਰ ਤਾਂ ਠੀਕ ਆਉਂਦੇ ਨੇ ਮੈਡੀਸਨ ਵਗੈਰਾ ਦਿੰਦੇ ਨੇ ਜਿਵੇਂ ਕਿ ਜਿਵੇਂ ਕਿ ਉਹ ਹਾਈ ਲੈਵਲ ਦੇ ਉੱਤੇ ਜਿਵ ਜਿਵੇਂ ਜੇ ਮੈਂ ਕੋਈ ਮੇਜਰ ਹੋ ਵੱਡੀ ਗੱਲਬਾਤ ਹੁੰਦੀ ਹੈ ਤਾਂ ਉਹਦੇ ਵਾਸਤੇ ਸਾਨੂੰ ਸ਼ਹਿਰ ਹੀ ਜਾਣਾ ਪੈਂਦਾ ਜਿੱਥੇ ਬੈੱਡ ਲੱਗੇ ਹੋਏ ਆ ਉੱਥੇ ਆਕਸੀਜਨ ਹਰ ਇੱਕ ਚੀਜ਼ ਉਪਲੱਬਧ ਆ ਅਤੇ ਹੋਰ ਸਮਾਨ ਹੈਵੀ ਮਸ਼ੀਨਾਂ ਐਕਸਰੇ ਮਸ਼ੀਨਾਂ ਵਗੈਰਾ ਹਰ ਇੱਕ ਚੀਜ਼ ਉੱਥੇ ਹੋਣ ਕਰਕੇ ਸਾਨੂੰ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਅਤੇ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਉੱਥੇ ਅਤੇ ਬਾਕੀ ਇੱਥੇ ਛੋਟੇ ਸ਼ਹਿਰ ਛੋਟੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਇਹ ਚੀਜ਼ਾਂ ਜਾਣੀ ਕਿ ਸਾਰੀਆਂ ਨਹੀਂ ਰੱਖ ਸਕਦੇ ਅਤੇ ਸਰਕਾਰ ਨੂੰ ਚਾਹੀਦਾ ਕਿ ਜਿਵੇਂ ਕਿ ਇੱਕ ਪਿੰਡਾਂ ਦਾ ਇੱਕ ਕਸ ਇੱਕ ਪਿੰਡਾਂ ਦਾ ਗਰੁੱਪ ਬਣਾ ਕੇ ਉਹਨਾਂ ਨੂੰ ਇੱਕ ਮੇਨ ਹੋਸਪਿਟਲ ਬਣਾ ਕੇ ਮੇਨ ਦਿੱਤਾ ਜਾਵੇ ਵੱਡਾ ਜਿੱਥੇ ਕਿ ਵੱਡੀਆਂ ਮਸ਼ੀਨਾਂ ਹਰ ਇੱਕ ਚੀਜ਼ ਉਪਲੱਬਧ ਹੋਵੇ ਵਧੀਆ ਡਾਕਟਰ ਅਤੇ ਹਰ ਇੱਕ ਚੀਜ਼ ਉੱਥੇ ਜਿਹੜੀ ਕਿ ਮੁਢਲੀ ਸਹਾਇਤਾ ਇੱਥੇ ਜਿਹੜੀ ਮਿਲ ਸਕੇ ਪਿੰਡਾਂ ਦੇ ਵਿੱਚ ਵੀ ਕਿਵੇਂ ਕਿ ਕੋਈ ਪੰਜ ਪਿੰਡਾਂ ਦਾ ਗਰੁੱਪ ਬਣਾ ਕੇ ਉਹਨਾਂ ਨੂੰ ਇੱਕ ਹੋਸਪਿਟਲ ਬਣਾ ਕੇ ਦੇਣਾ ਚਾਹੀਦਾ ਤਾਂ ਕਿਤੇ ਦੂਰ ਜਾਣ ਦੀ ਲੋੜ ਨਾ ਪਵੇ ਮੌਕੇ ਦੇ ਉੱਤੇ ਅਤੇ ਵਧੀਆ ਹੋਸਪਿਟਲ ਵਧੀਆ ਡਾਕਟਰ ਇਹ ਚੀਜ਼ਾਂ ਸਰਕਾਰ ਨੂੰ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਅਤੇ ਜਿਵੇਂ ਕਿ ਅ ਛੋ ਪਿੰਡਾਂ ਦੇ ਵਿੱਚ ਛੋਟੀਆਂ ਡਿਸਪੈਂਸਰੀਆਂ ਨਜਲਾ ਬੁਖਾਰ ਜੁਖਾਮ ਵਾਸਤੇ ਇਹ ਚੀਜ਼ਾਂ ਦਵਾਈ ਵਾਸਤੇ ਆਮ ਮਿਲ ਸਕਦੀਆਂ ਹੈ ਚਲੋ ਇੱਥੋਂ ਆਮ ਡਿਸਪੈਂਸਰੀਆਂ ਤੋਂ ਮਿਲ ਸਕਦੀਆਂ ਅਤੇ ਇਸ ਲਈ ਵੱਡੇ ਇਲਾਜ ਵਾਸਤੇ ਸਾਨੂੰ ਸ਼ਹਿਰਾਂ ਦੇ ਵਿੱਚ ਜਾਣਾ ਪਊਗਾ ਜੋ ਕਿ ਸਾਨੂੰ ਸਰਕਾਰ ਨੂੰ ਪਿੰਡਾਂ ਦੇ ਵਿੱਚ ਇਹਦੇ ਵਾਸਤੇ ਕਰਨਾ ਚਾਹੀਦਾ